ਸਾਡੇ ਭਾਈਚਾਰੇ ਵਿੱਚ ਬਹੁਤ ਤਰ੍ਹਾਂ ਦੇ ਪ੍ਰਸਿੱਧ ਭਾਈਚਾਰਕ ਸਮਾਗਮ ਹਨ ਜੋ ਕਿ ਮੇਲਿਆਂ ਦੇ ਨਾਮ ਨਾਲ ਜਾਣੇ ਜਾਂਦੇ ਹਨ ਅਤੇ ਬਹੁਤ ਤਰ੍ਹਾਂ ਦੇ ਮੇਲੇ ਪੰਜਾਬ ਦੇ ਵਿੱਚ ਅਲੱਗ ਅਲੱਗ ਜਗ੍ਹਾ ਉੱਤੇ ਲੱਗਦੇ ਹਨ ਜਿਵੇਂ ਕਿ ਮੁਕਤਸਰ ਮੇਲਾ ਕਿਲਾ ਰਾਏਪੁਰ ਖੇਡ ਮੇਲਾ ਜਰਗ ਦਾ ਮੇਲਾ ਅਤੇ ਛਪਾਰ ਦਾ ਮੇਲਾ ਬਾਬਾ ਸੋਢਲ ਦਾ ਮੇਲਾ ਤੁਹਾਨੂੰ ਮੈਂ ਜਰਗ ਦੇ ਮੇਲੇ ਵਿੱਚ ਬਾਰੇ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੰਦੀ ਹਾਂ ਇਹ ਮੇਲਾ ਤਹਿਸੀਲ ਪਾਇਲ ਦੇ ਪਿੰਡ ਜਰਗ ਵਿੱਚ ਲੱਗਦਾ ਹੈ ਇਹ ਮੇਲਾ ਚੇਤ ਵਿੱਚ ਸੀਤਲ ਮਾਤਾ ਦੇ ਸਨਮਾਨ ਵਿੱਚ ਲੱਗਦਾ ਹੈ ਇਸਨੂੰ ਬੀਬੜਿਆਂ ਦਾ ਮੇਲਾ ਵੀ ਕਹਿੰਦੇ ਹਨ ਇੱਕ ਦਿਨ ਪਹਿਲਾਂ ਮਿੱਠੇ ਗੁਲਗਲੇ ਬਣਾਏ ਜਾਂਦੇ ਹਨ ਅਤੇ ਫਿਰ ਮਾਤਾ ਨੂੰ ਮੱਥਾ ਟੇਕਿਆ ਜਾਂਦਾ ਹੈ ਮਗਰੋਂ ਇਹ ਪ੍ਰਸ਼ਾਦ ਗਧੇ ਨੂੰ ਚੜ੍ਹਾਇਆ ਜਾਂਦਾ ਹੈ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇਹ ਜੀਵ ਮਾਤਾ ਦਾ ਪਿਆਰਾ ਸੀ ਮਾਤਾ ਨੂੰ ਪੂਜਣ ਮਗਰੋਂ ਬਾਕੀ ਪਰਿਵਾਰ ਵੀ ਪ੍ਰਸ਼ਾਦ ਲੈਂਦਾ ਹੈ ਇਹ ਤਿਉਹਾਰ ਮਾਲਵਾ ਅਤੇ ਪੁਆਧ ਦੇ ਇਲਾਕਿਆਂ ਵਿੱਚ ਵੀ ਮਨਾਇਆ ਜਾਂਦਾ ਹੈ ਪਰ ਮੇਲਾ ਕੇਵਲ ਜਰਗ ਵਿੱਚ ਹੀ ਲੱਗਦਾ ਹੈ